ਸਤਿ ਸ਼੍ਰੀ ਅਕਾਲ ਸਰ ਜੀ ਮੈਂ ਰਿਤੂ ਬਾਲਾ ਬੋਲ ਰਹੀ ਹਾਂ ਅਸੀਂ ਨਾ ਕਿਤੇ ਘੁੰਮਣ ਜਾਣਾ ਸਾਨੂੰ ਗੱਡੀ ਚਾਹੀਦੀ ਹੈ ਗੱਡੀ ਕਰ ਦਿਉ ਸਾਨੂੰ ਅਤੇ ਕੋਈ ਦੋ ਦੋ ਕੁ ਹਜ਼ਾਰ ਤੱਕ ਗੱਡੀ ਕਰ ਦਿਉ ਮਲ ਕਿ ਠੀਕ ਠਾਕ ਗੱਡੀ ਹੋਏ ਅਸੀਂ ਡਰਾਈਵਰ ਵੀ ਕੋਈ ਚੰਗਾ ਚੰਗਾ ਭੇਜ ਦਿਉ ਅਸੀਂ ਪੂਰੀ ਫੈਮਿਲੀ ਜਾਣਾ ਚਾਹੁੰਦੇ ਹਾਂ ਅਤੇ ਸਾਨੂੰ ਉੱਥੇ ਛੱਡ ਕੇ ਆਓ ਅਸੀਂ ਨਾ ਉੱਥੇ ਘੁੰਮ ਕੇ ਆਉਣਾ ਚਾਹੁੰਦੇ ਹਾਂ ਅਤੇ ਸਾਡੇ ਨਾ ਉੱਥੇ ਮਲ ਕਿ ਸਾਰੇ ਪੈਸੇ ਖਰਚ ਹੋ ਗਏ ਆ ਅਤੇ ਹੁਣ ਸਾਨੂੰ ਮਲ ਕਿ ਅਸੀਂ ਘਰ ਆਉਣਾ ਚਾਹੁੰਦੇ ਸਾਡੇ ਇਸ ਪੈਸੇ ਉੱਥੇ ਸਾਰੇ ਮਲ ਕਿ ਖਰਚ ਹੋ ਖਰਚਾ ਗਏ ਹੈ ਅਤੇ ਹੁਣ ਮਲ ਕਿ ਅਸੀਂ ਤੁਹਾਡੇ ਮਲ ਕਿ ਪੈਸੇ ਜਿਹੜੇ ਆ ਗੁਗਲ ਪੇ ਕਰ ਸਕਦੇ ਹਾਂ ਨਾ ਗੂਗਲ ਪੇ ਕਰ ਦਈਏ

ਅਸੀਂ ਵਾਪਸ ਆਉਣਾ ਚਾਹੁੰਦੇ ਹਾਂ